ਹੈਲੋ ਸਰ ਕਮਲ ਕਿਵੇਂ ਹੋ ਬਸ ਵਧੀਆ ਵਧੀਆ ਵਧੀਆ ਔਰ ਸੋਚਿਆ ਕੁਛ ਅੱਗੇ ਦਾ ਪਲੈਨ ਦੇਖਿਆ ਕੋਈ ਕੋਲਜ ਲੱਗਿਆ ਸਹੀ ਜਾਂ ਨਹੀਂ ਹਾਂਜੀ ਕਿੱਥੇ ਦੇਖੇ ਸੀ ਹਾਂਜੀ ਓਨਲੀ ਫ਼ੋਰ ਗਰਲਜ਼ ਕੋਲੇਜ ਫਿਰ ਉੱਥੇ ਤਾਂ ਪੋਸੀਬਿਲਟੀ ਤੁਹਾਨੂੰ ਪਤਾ ਸਾਡੀ ਹੈ ਨਹੀਂ ਅਸੀਂ ਸ਼ੁਰੂ ਤੋਂ ਹੀ ਬੋਆਇਸ ਗਰਲਜ਼ ਇਕੱਠੇ ਪੜ੍ਹੇ ਹੋਏ ਹਾਂ ਤਾਂ ਫਿਰ ਇਹੀ ਦੱਸਦਾ ਕਿ ਅਸੀਂ ਇਕੱਠੇ ਹੈ ਨਾ ਕਰੀਏ ਕਿਉਂਕਿ ਮੈਂ ਸੁਣਿਆ ਹੈ ਕਿ ਜਿਹੜੇ ਇਕੱਲੇ ਗਰਲਸ ਕੋਲਜ ਹੁੰਦੇ ਆ ਉਹਦੇ ਵਿੱਚ ਬਹੁਤ ਟੋਰਚਰ ਕਰਦੇ ਆ ਇੱਕ ਦੂਸਰੇ ਨੂੰ ਡਰੱਗਜ਼ ਵਗੈਰਾ ਵੀ ਕਾਫੀ ਚੱਲ ਰਹੇ ਹੋਏ ਪਏ ਨੇ ਉੱਥੇ ਹੈ ਨਾ ਅਤੇ ਓਕੇ ਹਾਂਜੀ ਮੈਂ ਵੀ ਇੱਕ ਕੋਲੇਜ ਦੇਖਿਆ ਸੀ ਕੋਲੇਜ ਕੋਲੇਜ ਵੀ ਕਾਫੀ ਵੱਡਾ ਸੀਗਾ ਸਟੂਡੈਂਟ ਵੀ ਸੀ ਲੇਕਿਨ ਸਟੱਡੀ ਵੀ ਕਾਫੀ ਸਹੀ ਹੈ ਟੀਚਰ ਵੀ ਲੇਕਿਨ ਡਿਸਿਪਲਨ ਨਹੀਂ ਹੈ ਉੱਥੇ ਹਾਂ ਉਹ ਤਾਂ ਨਸੇਸਰੀ ਹੁੰਦਾ ਬਟ ਨਹੀਂ ਮੈਂ ਖੁਦ ਦੇਖ ਕੇ ਆਈ ਹਾਂ ਨਾ ਮੈਨੂੰ ਕਿਸੇ ਨੇ ਸੁਜੈਸਟ ਕੀਤਾ ਸੀਗਾ ਮੇਰਾ ਫਰੈਂਡ ਹੀ ਸੀਗਾ ਬਟ ਨਹੀਂ ਉਹ ਕੋਲੇਜ ਨਹੀਂ ਸਹੀ ਰਿਹਾ ਮਤਲਬ ਬਿਲਕੁਲ ਮੈਨੂੰ ਤਾਂ ਸਹੀ ਨਹੀਂ ਲੱਗਾ ਹਾਂਜੀ ਹਾਂਜੀ ਮੈਂ ਵੀ ਤੁਹਾਡੇ ਨਾਲ ਉਹਦੇ ਬਾਰੇ ਹੀ ਗੱਲ ਕਰਨੀ ਸੀ ਮੈਨੂੰ ਵੀ ਕੱਲ੍ਹ ਹੀ ਪਤਾ ਚੱਲਿਆ ਤਾਂ ਕੋਲੇਜ ਜਿਹੜਾ ਕਿ ਯੂਨੀਵਰਸਿਟੀ ਬਣ ਚੁੱਕਿਆ ਯੂਨੀਵਰਸਿਟੀ

ਹਾਂਜੀ ਕਿਆ ਰੇਟ ਸੀ ਮੇਰੀ ਵੀ ਭੂਆ ਜੀ ਹੈ ਨਾ ਉਹ ਸਿੰਘਾਪੁਰ ਨੇ ਤਾਂ ਉਹ ਕਹਿ ਰਹੇ ਸੀਗੇ ਉਹਨਾਂ ਨੇ ਸਰਚ ਕੀਤਾ ਸੀਗਾ ਗੂਗਲ 'ਤੇ ਅਤੇ ਗੂਗਲ ਨੇ ਗੂਗਲ ਦੇ ਥਰੂ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਵਰਿੰਦ ਕੋਲੇਜ ਜਾਓ ਕਹਿੰਦੇ ਉਹ ਕਾਫੀ ਵਧੀਆ ਉੱਥੇ ਮਤਲਬ ਕਿ ਜਿੱਦਾਂ ਕਹਿੰਦੇ ਆ ਨਾ ਧੱਕਾ ਵਗੈਰਾ ਚੱਲਦਾ ਉਹ ਨਹੀਂ ਆ ਕਹਿੰਦੇ ਬਹੁਤ ਸਹੀ ਤਰ੍ਹਾਂ ਉੱਥੇ ਟੀਚਰਸ ਵੀ ਸਟੂਡੈਂਟਸ ਵੀ ਹਾਂਜੀ ਹਾਂਜੀ ਤਾਂ ਫਿਰ ਇੱਥੇ ਟਰਾਈ ਕਰ ਲਈਏ ਆਪਾਂ ਵੈਸੇ ਤੁਸੀਂ ਕਰਨੀ ਇੰਜੀਨੀਅਰਿੰਗ ਹੈ ਹਾਂਜੀ ਮੈਂ ਵੀ ਉਹੀ ਕਰਨੀ ਆ ਜੀ ਚਲੋ ਠੀਕ ਹੈ ਫਿਰ ਅਸੀਂ ਜਾਵਾਂਗੇ ਠੀਕ ਹੈ ਕੱਲ੍ਹ ਚਲੇ ਜਾਵਾਂਗੇ ਸਵੇਰ ਦੇ ਟਾਈਮ ਠੀਕ ਹੈ ਬਾਏ